ਸਕੂਲ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਲਈ ਕਾਫੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਟੀਚਰਾਂ ਦੀ ਲੋੜ ਦੀਆਂ ਚੀਜ਼ਾਂ ਨੂੰ ਪੂਰਾ ਕੀਤਾ ਸਮੇਂ ਸਿਰ ਪੂਰਾ ਕੀਤਾ ਜਾ ਸਕੇ ਤਾਂ ਕਿ ਟੀਚਰ ਨੂੰ ਬੱਚੇ ਨੂੰ ਪੜ੍ਹਾਉਣ ਦੇ ਵਿੱਚ ਕੋਈ ਮੁਸ਼ਕਿਲ ਨਾ ਆ ਸਕੇ ਜੇਕਰ ਬੱਚਾ ਅੱਛੀ ਤਰ੍ਹਾਂ ਟੀਚਰ ਰਿਲੈਕਸ ਹੋ ਕੇ ਬੱਚੇ ਨੂੰ ਅੱਛੀ ਤਰ੍ਹਾਂ ਪੜ੍ਹਾ ਰਿਹਾ ਕੋਈ ਵੀ ਦਿੱਕਤ ਨਹੀਂ ਆ ਰਹੀ ਤਾਂ ਹੀ ਤਾਂ ਬੱਚੇ ਅੱਛੇ ਨੰਬਰ ਲੈ ਕੇ ਪਾਸ ਹੋਣਗੇ ਤਾਂ ਹੀ ਸਕੂਲ ਦਾ ਰਿਜ਼ਲਟ ਹੰਡਰੰਟ ਪਰਸੈਂਟ ਆਏਗਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਟੀਚਰਾਂ ਨੂੰ ਪ੍ਰੋਜੈਕਟਡ ਹਰ ਹਰ ਕਲਾਸ ਪ੍ਰੋਜੈਕਟ ਲੱਗਿਆ ਹੋਣਾ ਚਾਹੀਦਾ ਹਰ ਇੱਕ ਕਲਾਸ 'ਚ ਨਹੀਂ ਹਰ ਕਲਾਸ ਦੇ ਵਿੱਚ ਪ੍ਰੋਜੈਕਟ ਹੋਣਾ ਚਾਹੀਦਾ ਜਿਸ ਦੇ ਰਾਹੀਂ ਟੀਚਰ ਬੱਚੇ ਨੂੰ ਸਕਰੀਨ ਦੇ ਉੱਤੇ ਪੜ੍ਹਾ ਸਕੇ ਜਿਹੜੇ ਅੱਜ ਕੱਲ੍ਹ ਕੰਪਿਊਟਰ ਯੁਗ ਹੈ ਸਕਰੀਨ ਦੇ ਉੱਤੇ ਪੜ੍ਹੇ ਹੋਏ ਆ ਬੱਚੇ ਦੇ ਦਿਮਾਗ ਦੇ ਵਿੱਚ ਬਹੁਤ ਜਲਦੀ ਪੈਂਦਾ ਬਹੁਤ ਜਲਦੀ ਕੈਚ ਕਰਦੇ ਆ ਬੱਚੇ ਅੱਜ ਕੱਲ੍ਹ ਕੰਪਿਊਟਰ ਯੁਗ ਹੈ ਸਭ ਕੁਝ ਆਨਲਾਈਨ ਹੋ ਰਿਹਾ ਬੱਚੇ ਫੋਨਾਂ 'ਤੇ ਲੈਕਚਰ ਲਾ ਕੇ ਪੜ੍ਹ ਰਹੇ ਆ ਉਹਨਾਂ ਨੂੰ ਬਹੁਤ ਜਲਦੀ ਸਮਝ ਆਉਂਦੀ ਹੈ ਇਸ ਲਈ ਹਰ ਟੀਚਰ ਨੂੰ ਹਰ ਕਲਾਸ ਨੂੰ ਪ੍ਰੋਜੈਕਟ ਦਿੱਤਾ ਜਾਣਾ ਚਾਹੀਦਾ ਹਰ ਇੱਕ ਬੱਚਾ ਪ੍ਰੋਜੈਕਟ ਰਾਹੀਂ ਪੜ੍ਹੇ ਅਤੇ ਬੱਚਾ ਜਲਦੀ ਕੈਚ ਕਰਦਾ ਅਤੇ ਉਹ ਬੱਚੇ ਦਾ ਨਾਈਨਟੀ ਨਾਈਨ ਪਰਸੈਂਟ ਰਿਜਲਟ ਲੈ ਕੇ ਆਉਂਦਾ ਦੂਸਰੀ ਗੱਲ ਬੱਚਿਆਂ ਟੀਚਰਾਂ ਵਾਸਤੇ ਬਲੈਕ ਬੋਰਡ ਹੋਣੇ ਚਾਹੀਦੇ ਆ ਵਾਈਟ ਬਲੈਕ ਬੋਰਡ ਹੋਣੇ ਚਾਹੀਦੇ ਆ ਹਰ ਚੀਜ਼ ਸਕੂਲ ਦੇ ਵਿੱਚ ਮੁਹੱਈਆ ਹੋਣੀ ਚਾਹੀਦੀ ਹੈ ਤਾਂ ਕਿ ਟੀਚਰ ਨੂੰ ਬੱਚਿਆਂ ਨੂੰ ਪੜ੍ਹਾਉਣ ਵਿੱਚ ਕੋਈ ਦਿੱਕਤ ਨਾ ਆਵੇ ਦੂਸਰੀ ਗੱਲ ਤੀਸਰੀ ਗੱਲ ਇਹ ਕਲਾਸ ਦਾ ਮਾਹੌਲ ਸ਼ਾਂਤਮਈ ਹੋਣਾ ਚਾਹੀਦਾ ਹਰ ਇੱਕ ਬੱਚਾ ਟੀਚਰ ਦੀ ਗੱਲ ਇਸ਼ਾਰੇ ਨੂੰ ਸਮਝਣਾ ਹੋਣਾ ਚਾਹੀਦਾ ਸਮਝਦਾ ਹੋਵੇ ਅਤੇ ਟੀਚਰ ਦੀ ਇੱਜ਼ਤ ਕਰਦਾ ਹੋਵੇ ਅਤੇ ਟੀਚਰ ਦੇ ਇੱਕ ਇਸ਼ਾਰੇ ਦੇ ਵਿੱਚ ਕਲਾਸ ਸ਼ਾਂਤ ਹੋ ਜਾਣੀ ਚਾਹੀਦੀ ਹੈ ਅਤੇ ਸਾਰੇ ਬੱਚੇ ਟੀਚਰ ਦੇ ਇਸ਼ਾਰੇ ਨੂੰ ਸਮਝਣ ਯੋਗ ਹੋਣੇ ਚਾਹੀਦੇ ਹੈ ਤਾਂ ਕਿ ਪੜ੍ਹਾਉਣ ਦੇ ਵਿੱਚ ਟੀਚਰ ਨੂੰ ਕੋਈ ਵੀ ਦਿੱਕਤ ਨਾ ਆਵੇ ਦੂਜੀ ਚੌਥੀ ਗੱਲ ਇਹ ਸਕੂਲ ਦਾ ਪ੍ਰਿੰਸੀਪਲ ਬਹੁਤ ਜ਼ਿਆਦਾ ਵਧੀਆ ਅਤੇ ਸਮਝਦਾਰ ਹੋਣਾ ਚਾਹੀਦਾ ਹੈ ਉਹ ਟੀਚਰਾਂ ਦੀ ਅ ਆਉਣ ਵਾਲੀ ਪ੍ਰੋਬਲਮ ਨੂੰ ਸਮਝ ਸਕੇ ਅਤੇ ਉਸਦਾ ਹੱਲ ਲੋੜ ਪੈਣ 'ਤੇ ਸਮੇਂ ਸਿਰ ਕਰ ਸਕੇ